ਵਿਆਹ ਨੂੰ ਭਾਰਤੀ ਪਰਿਵਾਰ ਵਿੱਚ ਸਭ ਤੋਂ ਮਹੱਤਵਪੂਰਨ ਜਸ਼ਨ ਮੰਨਿਆ ਜਾਂਦਾ ਹੈ ਪਿੰਡਾਂ ਵਿੱਚ ਵਿਆਹਾਂ ਦਾ ਇੱਕ ਵਿਸ਼ੇਸ਼ ਆਕਰਸ਼ਣ ਹੁੰਦਾ ਹੈ ਜੋ ਸ਼ਹਿਰੀ ਵਿਆਹਾਂ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਪਿੰਡਾਂ ਵਿੱਚ ਜ਼ਿਆਦਾਤਰ ਵਿਆਹ ਅਰੇਂਜ ਮੈਰਿਜ ਹੁੰਦੇ ਹਨ ਅਤੇ ਰੀਤੀ ਰਿਵਾਜ਼ਾਂ ਅਤੇ ਰੀਤੀ ਰਿਵਾਜ਼ਾਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਉਹ ਵਿਆਹ ਹੁੰਦੇ ਹਨ ਲਾੜੀ ਦੇ ਪਰਿਵਾਰਿਕ ਮੈਂਬਰ ਵਿਆਹ ਦੇ ਸਾਰੇ ਵੇਰਵਿਆਂ ਨੂੰ ਦੇਖਦੇ ਹਨ ਅਤੇ ਸਾਰੀਆਂ ਰਸਮਾਂ ਨੂੰ ਪੂਰੀਆਂ ਕਰਦੇ ਹਨ ਜਿਵੇਂ ਕਿ ਪਿੰਡਾਂ ਵਿੱਚ ਵਿਆਹ ਦਾ ਸਮਾਰੋਹ ਦਾ ਸਥਾਨ ਦੁਲਹਨ ਦਾ ਘਰ ਹੁੰਦਾ ਹੈ ਆਮ ਕਰਕੇ ਪਿੰਡ ਦੇ ਵਿੱਚ ਕੋਈ ਮੋਹਤਬਰ ਬੰਦਾ ਹੈ ਹੁੰਦਾ ਹੈ ਜਿਸ ਨੂੰ ਵਿਚੋਲਾ ਕਿਹਾ ਜਾਂਦਾ ਹੈ ਉਹੀ ਵਿਆਹ ਸ਼ਾਦੀਆਂ ਵਿੱਚ ਇੱਕ ਦੂਜੇ ਨੂੰ ਮਿਲਾਉਣ ਦੀ ਰਸਮ ਅਦਾ ਕਰਦਾ ਹੈ ਜੋ ਬਹੁਤ ਸਾਰੇ ਪਰਿਵਾਰਾਂ ਨੂੰ ਜਾਣਦਾ ਹੁੰਦਾ ਹੈ ਪਿੰਡਾਂ ਵਿੱਚ ਵਿਆਹ ਲਈ ਕਈ ਦਿਨਾਂ ਦੇ ਹੁੰਦੇ ਹਨ ਕਿਉਂਕਿ ਦੋਵਾਂ ਜੋੜਿਆਂ ਦੇ ਪਰਿਵਾਰਿਕ ਮੈਂਬਰਾਂ ਦੋਸਤਾਂ ਅਤੇ ਹੋਰ ਰਿਸ਼ਤੇਦਾਰਾਂ ਨਾਲ ਇੱਕ ਛੱਤ ਹੇਠ ਇਕੱਠੇ ਹੁੰਦੇ ਹਨ ਪਿੰਡ ਦੇ ਸਾਰੇ ਲੋਕ ਵੀ ਵਿਆਹ ਸਮਾਰੋਹ ਵਿੱਚ ਸ਼ਾਮਿਲ ਹੁੰਦੇ ਹਨ ਜੋੜੇ ਦੇ ਪਰਿਵਾਰਿਕ ਮੈਂਬਰ ਸਾਰੇ ਪ੍ਰਬੰਧਾਂ ਦੀ ਦੇਖਭਾਲ ਕਰਦੇ ਹਨ ਜਿਸ ਵਿੱਚ ਵਿਆਹ ਸਥਾਨ 'ਤੇ ਵਿਆਹ 'ਤੇ ਪਰੋਸਿਆ ਜਾਣ ਵਾਲਾ ਭੋਜਨ ਨਤੀਜੇ ਵਜੋਂ ਪਿੰਡ ਵਿੱਚ ਵਿਆਹ ਯੋਜਨਾਕਾਰ ਦੀ ਭੂਮਿਕਾ ਨਹੀਂ ਹੈ ਹਾਲਾਂਕਿ ਸ਼ਹਿਰ ਵਿੱਚ ਵਿਆਹ ਦੀ ਸਾਰੀ ਚਮਕ ਅਤੇ ਗਲੈਮਰ ਪਿੰਡ ਦੇ ਵਿਆਹ ਵਿੱਚ ਗਾਇਬ ਹੋ ਸਕਦੀ ਹੈ ਪਰ ਮਨੋਰੰਜਨ ਅਤੇ ਆਨੰਦ ਪਿੰਡਾਂ ਵਿੱਚ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਕਿਉਂਕਿ ਲੋਕ ਨਾਚ ਭੰਗੜਾ ਗਿੱਧਾ ਅ ਜਾਗੋ ਐ ਅਜਿਹੇ ਪ੍ਰੋਗਰਾਮ ਇਸ ਵਿਆਹ ਸ਼ਾਦੀ ਨੂੰ ਚਾਰ ਚੰਦ ਲਾ ਦਿੰਦੇ ਹਨ ਸ਼ੁਰੂਆਤੀ ਦਿਨਾਂ ਵਿੱਚ ਪਿੰਡ ਵਿੱਚ ਕੁੜੀਆਂ ਲਈ ਬਾਲ ਵਿਆਹ ਇੱਕ ਨਿਯਮ ਮੰਨਿਆ ਜਾਂਦਾ ਸੀ ਪਰ ਬਦਲਦੇ ਸਮੇਂ ਦੇ ਨਾਲ ਵਧੇਰੇ ਕੁੜੀਆਂ ਦਾ ਵਿਆਹ ਅਠਾਰ੍ਹਾਂ ਸਾਲ ਦੀ ਉਮਰ ਤੋਂ ਬਾਅਦ ਹੀ ਕੀਤਾ ਜਾਂਦਾ ਹੈ ਜੋ ਕਿ ਭਾਰਤ ਵਿੱਚ ਵਿਆਹ ਦੀ ਕਾਨੂੰਨੀ ਉਮਰ ਹੈ ਕਿਉਂਕਿ ਪਿੰਡਾਂ ਵਿੱਚ ਵਿਆਹ ਲੰਬੇ ਸਮੇਂ ਤੋਂ ਹੁੰਦੇ ਹਨ ਇੱਥੇ ਬਹੁਤ ਸਾਰੀਆਂ ਰਸਮਾਂ ਅਤੇ ਰੀਤੀ ਰਿਵਾਜ਼ ਹਨ ਜੋ ਵਿਆਹ ਤੋਂ ਬਾਅਦ ਦੀਆਂ ਰਸਮਾਂ ਅਤੇ ਪਾਲਣ ਕੀਤੇ ਜਾਂਦੇ ਹਨ ਪਿੰਡਾਂ ਵਿੱਚ ਵਿਆਹ ਇੱਕ ਮਜ਼ੇਦਾਰ ਮਾਹੌਲ ਹੁੰਦਾ ਹੈ ਜਿੱਥੇ ਰਿਸ਼ਤੇਦਾਰਾਂ ਨਾਲ ਪਰਿਵਾਰ ਦੇ ਸਾਰੇ ਮੈਂਬਰ ਸਮਾਰੋਹ ਦਾ ਹਿੱਸਾ ਬਣਦੇ ਹਨ ਇਕੱਠ ਲਈ ਗੀਤਾਂ ਵਿੱਚ ਨਾਚ ਪ੍ਰੋਗਰਾਮ ਹੁੰਦਾ ਹੈ ਜਨਤਕ ਭਾਗੀਦਾਰੀ ਸਮਾਰੋਹ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਪਿੰਡਾਂ ਵਿੱਚ ਮੰਦਰ ਗਿਰਜਾਘਰ ਮਸਜਿਦ ਗੁਰਦੁਆਰੇ ਮੰਦਰ ਇੱਕ ਵਿਲੱਖਣ ਸਥਾਨ ਮੰਨੇ ਜਾਂਦੇ ਹਨ ਪਿੰਡਾਂ ਵਿੱਚ ਵਿਆਹ ਦੀ ਰੌਣਕ ਦੇਖਣ ਯੋਗ ਹੁੰਦੀ ਹੈ